ਹੈਲੋ ਹਾਂਜੀ ਸੰਜੇ ਸਰ ਬੋਲ ਰਹੇ ਆ ਹਾਂਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕੋਈ ਪਿੱਛੋਂ ਆਵਾਜ਼ ਬੜੀ ਆ ਰਹੀ ਸ਼ੋਰ ਬਹੁਤ ਪੈ ਰਿਹਾ ਗੱਲ ਹੋ ਜਾਏਗੀ ਆਰਾਮ ਨਾਲ ਉਹ ਹੋ ਸੱਚੀ ਗੱਲ ਸਰ ਕ ਹਾਂਜੀ ਉਹੀ ਨਾ ਲੋਕੀ ਲਾਈਟਾਂ ਵੀ ਨਹੀਂ ਦੇਖਦੇ ਰੈੱਡ ਲਾਈਟ ਹੈ ਜਦੋਂ ਤੁਸੀਂ ਰੁਕੇ ਵੇ ਹੀ ਹੈ ਫਟਾਫਟ ਵਿੱਚੋਂ ਨਿਕਲਣ ਦੀ ਕਰਦੇ ਹੈ

ਸਰਕਾਰ ਨੂੰ ਚਾਹੀਦਾ ਕੁਛ ਕਰੇ ਇਹੋ ਜਿਹਾ ਇੰਤਜਾਮ ਚਾਹੀਦਾ ਸਰਕਾਰ ਨੂੰ ਕੁਛ ਕਰੇ ਰਾਮ

ਹਾਂ ਚਲੋ ਕੋਈ ਨਹੀਂ ਤੁਸੀਂ ਘਰ ਪਹੁੰਚੋਗੇ ਨਾ ਹਾਂ ਹਾਂ ਹਾਂ ਠੀਕ ਹੈ ਠੀਕ ਹੈ ਘਰ ਪਹੁੰਚ ਕੇ ਫਿਰ ਮੈਨੂੰ ਦੱਸ ਦੇਣਾ ਓਕੇ ਥੈਂਕ ਯੂ